ਮੇਰੇ ਕੋਲ ਪਹਿਲਾਂ ਇੱਕ ਐਂਡਰਾਇਡ ਫੋਨ ਹੁੰਦਾ ਸੀ ਅਤੇ ਉਸ ਤੋਂ ਕੁਝ ਸਮੇਂ ਬਾਅਦ ਮੈਂ ਆਈ ਓ ਐਸ ਫੋਨ ਲੈ ਲਿਆ ਜਿਸ ਦੀ ਟੈਕਨੋਲੋਜੀ ਸਮਝਣ ਵਿੱਚ ਮੈਨੂੰ ਬਹੁਤ ਔਖ ਹੋਈ ਕਿਉਂਕਿ ਇਸ ਤੋਂ ਪਹਿਲਾਂ ਮੈਂ ਕੋਈ ਆਈਫੋਨ ਜਾਂ ਆਈ ਓ ਐਸ ਸਾਫਟਵੇਅਰ ਦਾ ਫੋਨ ਨਹੀਂ ਚਲਾਇਆ ਸੀ ਅਤੇ ਉਸ ਨੂੰ ਸਮਝਣ ਲਈ ਮੈਨੂੰ ਯੂਟੀਊਬ ਦੀ ਮਦਦ ਲੈਣੀ ਪਈ ਯੂਟੀਊਬ ਦੀ ਮਦਦ ਨਾਲ ਮੈਂ ਕੁਝ ਉਸਨੂੰ ਚਲਾਉਣਾ ਸਿੱਖਿਆ ਅਤੇ ਹੌਲੀ ਹੌਲੀ ਉਸ ਵਿੱਚ ਆਪਣਾ ਹੱਥ ਸੈੱਟ ਕੀਤਾ ਤਾਂ ਕਿ ਮੈਂ ਉਸਨੂੰ ਚੰਗੇ ਤਰੀਕੇ ਨਾਲ ਚਲਾ ਸਕਾਂ ਮੈਂ ਇਸ ਤੋਂ ਪਹਿਲਾਂ ਕਦੇ ਵੀ ਆਈਫੋਨ ਨਹੀਂ ਚਲਾਇਆ ਸੀ ਅਤੇ ਜਦੋਂ ਮੈਂ ਨਵਾਂ ਆਈਫੋਨ ਲਿਆ ਤਾਂ ਮੈਨੂੰ ਇੰਨੀ ਔਖ ਹੋਈ ਕਿ ਮੈਨੂੰ ਉਸਦਾ ਲੋਕ ਖੋਲ੍ਹਣਾ ਤੱਕ ਨਾ ਆਵੇ ਪਰ ਜਦੋਂ ਮੈਂ ਉਸ ਬਾਰੇ ਆਪਣੇ ਯੂਟਿਊਬ ਤੋਂ ਦੇਖਿਆ ਤਾਂ ਮੈਨੂੰ ਸਮਝ ਆਇਆ ਕਿ ਇਸ ਨੂੰ ਕਿਵੇਂ ਚਲਾਉਣਾ ਅਤੇ ਇਸਦਾ ਪ੍ਰਯੋਗ ਕਿੱਦਾਂ ਕਰਨਾ ਹੈ ਤਾਂ ਉਸਦੀ ਮਦਦ ਨਾਲ ਮੈਂ ਇਸ ਨੂੰ ਪ੍ਰਯੋਗ ਕਰਨਾ ਸਿੱਖਿਆ ਅਤੇ ਅੱਜ ਮੈਂ ਇੱਕ ਬਹੁਤ ਵਧੀਆ ਤਰੀਕੇ ਨਾਲ ਆਪਣਾ ਜਿਹੜਾ ਆਈਫੋਨ ਚਲਾ ਸਕਦਾ ਹਾਂ ਅਤੇ ਮੈਂ ਅੱਜ ਤੋਂ ਬਾਅਦ ਅਗਰ ਮੈਨੂੰ ਮੋਬਾਇਲ ਨਵਾ ਚੇਂਜ ਕਰਨਾ ਹੋਵੇ ਤਾਂ ਮੈਂ ਆਈ ਫੋਨ ਹੀ ਲਊਂਗਾ ਮੈਨੂੰ ਉਸ ਦੀ ਟੈਕਨੋਲੋਜੀ ਇੰਨੀ ਵਧੀਆ ਲੱਗੀ